ਮੇਰੇ ਦੁਆਰਾ ਇਕੱਠੇ ਕੀਤੇ ਗਏ ਸਟੈਂਪ ਸਿੱਕੇ ਬਹੁਤ ਜ਼ਿਆਦਾ ਮੈਂ ਬਚਪਨ ਦੇ ਵਿੱਚ ਨੰਬਲ ਚੱਲਦੇ ਇਕੱਠੇ ਕੀਤੇ ਹਨ ਜਿਸ ਦਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮੁੱਲ ਹੈ ਜਦੋਂ ਮੈਂ ਉਹਨਾਂ ਨੂੰ ਦੇਖ ਕੇ ਡੱਬੇ ਦੇ ਵਿੱਚੋਂ ਖੋਲ੍ਹ ਕੇ ਦੇਖਦਾ ਹਾਂ ਅਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਇਸ ਦਾ ਅੱਜ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮੁੱਲ ਹੈ